ਪੰਜਾਬ ਵਿੱਚ ਬਹੁਤ ਤਕਨਾਲੋਜੀ ਆਈ ਹੈ ਜਿਵੇਂ ਕਿ ਟੈਲੀਫੋਨ ਮੋਬਾਇਲ ਐਲ ਸੀ ਡੀਆਂ ਕੰਪਿਊਟਰ ਵਗੈਰਾ ਸਾਰੇ ਹੁਣ ਅੱਜ ਕੱਲ੍ਹ ਐਲ ਸੀ ਡੀ ਕੰਪਿਊਟਰ ਨਾਲ ਕੰਮ ਕੀਤਾ ਜਾਂਦਾ ਪਹਿਲਾਂ ਸਮੇਂ 'ਚ ਇਹ ਕੰਮ ਨਾ ਹੱਥਾਂ ਨਾਲ ਕਰਦੇ ਸੀ ਹੁਣ ਕੰਪਿਊਟਰਾਂ ਵਗੈਰਾ ਨਾਲ ਹੀ ਕਰਿਆ ਜਾਂਦਾ ਲੋਕ ਪਹਿਲਾਂ ਹੱਥਾਂ ਨਾਲ ਕਢਾਈ ਕੱਢਣੀ ਬੁਣਾਈ ਖੱਡੀ ਚਾਦਰਾਂ ਬਣਾਉਣੀਆਂ ਕਰੋਸ਼ੀਏ ਦਾ ਕੰਮ ਕਰਨਾ ਚਾਦ ਦਰੀਆਂ ਬਣਾਉਣੀਆਂ ਇਹ ਹੱਥ ਨਾਲ ਕੰਮ ਕੀਤਾ ਜਾਂਦਾ ਸੀ ਪਰ ਅੱਜ ਕੱਲ੍ਹ ਮਸ਼ੀਨਾਂ ਚੱਲ ਪਈਆਂ ਹਨ ਲੋਕ ਉਹਨਾਂ ਨਾਲ ਉਹਨਾਂ ਦੀ ਮਦਦ ਨਾਲ ਮਸ਼ੀਨਾਂ 'ਤੇ ਕੰਮ ਕਰਦੇ ਹਨ ਪਹਿਲਾਂ ਪੇਂਟਿੰਗ ਕਰਦੇ ਸੀ ਹੱਥਾਂ ਨਾਲ ਹੁਣ ਡੇਜਰਕ ਪ੍ਰਿੰਟਰ ਪੇਂਟਿੰਗ ਆ ਗਈ ਆ ਹੁਣ ਐਂ ਲੱਗਦਾ ਜਿਵੇਂ ਓਰੀਜਨਲ ਪੇਂਟਿੰਗ ਪਹਿਲਾਂ ਲੋਕ ਹੱਥਾਂ ਨਾਲ ਪੇਂਟਿੰਗ ਕਰਦੇ ਸੀ ਹੁਣ ਮਸ਼ੀਨਾਂ ਹੀ ਇਹੋ ਜਿਹੀ ਚੱਲ ਪਈਆਂ ਜਿਹੜਾ ਹੱਥਾਂ ਨਾਲ ਕੰਮ ਕਰਨ ਦੀ ਬਜਾਏ ਮਸ਼ੀਨਾਂ ਨਾਲ ਕੀਤਾ ਜਾਂਦਾ ਲੋਕਾਂ ਦੀ ਤਕਨਾਲੋਜੀ ਇੰਨੀ ਵੱਧ ਗਈ ਹੈ ਲੋਕ ਪਹਿਲਾਂ ਪਹਿਲਾਂ ਦੇ ਸਮੇਂ 'ਚ ਇਹਨਾਂ ਨੂੰ ਆਪਣੇ ਘਰਾਂ ਵਿੱਚ ਕਰਦੇ ਸਨ ਬਹੁਤ ਟੈਮ ਲੱਗਦਾ ਸੀ ਪਰ ਹੁਣ ਲੋਕ ਹੱਥ ਮਸ਼ੀਨਾਂ ਨਾਲ ਕੀਤਾ ਜਾਂਦਾ ਅਤੇ ਘੱਟ ਟਾਈਮ ਲੱਗਦਾ ਲੋਕਾਂ ਨੂੰ ਪਹਿਲਾਂ ਨਾਲੋਂ ਹੁਣ ਜ਼ਿਆਦਾ ਆਸਾਨੀ ਨਾਲ ਕੰਮ ਕਰਨਾ ਮਿਲਦਾ ਹੈ ਪਹਿਲਾਂ ਲੋਕ ਸੂਟ ਪੇਂਟਿੰਗ ਵਗੈਰਾ ਕੱਢਦੇ ਸਨ ਪਰ ਹੁਣ ਜ਼ਿਆਦਾ ਪੇਂਟਿੰਗ ਕਢਾਈ ਲਿਖਾ ਕਢਾਈ ਬੁਣਾਈ ਸਾਰਾ ਕੁਛ ਮਸ਼ੀਨਾਂ ਰਾਹੀਂ ਕੀਤਾ ਜਾਂਦਾ ਹੈ ਪੇਂਟਿੰਗ ਡਿਜਲਿਕ ਰੀਜਨਲ ਐਂ ਲੱਗਦਾ ਜਿਵੇਂ ਕਿ ਹੁਣ ਹੱਥ ਆਹਾ ਮਸ਼ੀਨਾਂ ਰਾਹੀਂ ਕੱਢ ਕੇ ਕੀਤੀ ਜਾਂਦੀਆਂ ਹਨ